ਵੈਸੇ ਤਾਂ ਮੈਨੂੰ ਕਦੇ ਸੱਭਿਆਚਾਰ ਕੜਕ ਝੜਕੇ ਦਾ ਕੋਈ ਵੀ ਅਨੁਭਵ ਨਹੀਂ ਹੋਇਆ ਹੈ ਪਰ ਪਿਛਲੇ ਸਾਲ ਜਦ ਮੈਂ ਸਿੰਘਾਪੁਰ ਗਈ ਸੀ ਉੱਥੇ ਸਾਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਅਸੀਂ ਸ਼ੁਰੂ ਤੋਂ ਇੰਡੀਆ ਵਿੱਚ ਰਹਿੰਦੇ ਹਾਂ ਸਾਨੂੰ ਇੰਡੀਆ ਦੇ ਰੀਤੀ ਰਿਵਾਜ ਰਹਿਣ ਸਹਿਣ ਖਾਣ ਪੀਣ ਪਹਿਰਾਵੇ ਦਾ ਹਰ ਇੱਕ ਚੀਜ਼ ਦਾ ਪਤਾ ਹੈ ਪਰ ਸਿੰਘਾਪੁਰ ਜੋ ਕਿ ਇੱਕ ਅਲੱਗ ਹੀ ਕੰਟਰੀ ਹੈ ਉਹਨਾਂ ਉੱਥੇ ਦੇ ਲੋਕ ਨਾ ਹੀ ਇੰਗਲਿਸ਼ ਸਮਝਦੇ ਹਨ ਨਾ ਹੀ ਉਹਨਾਂ ਨੂੰ ਹੋਰ ਕੋਈ ਲੈਂਗੁਏਜ ਸਮਝ ਆਉਂਦੀ ਹੈ ਅਤੇ ਨਾ ਹੀ ਸਾਨੂੰ ਸਮਝ ਆਉਂਦੀ ਹੈ ਨਾ ਹੀ ਉਹਨਾਂ ਨੂੰ ਸਮਝ ਆਉਂਦੀ ਜਿਸ ਕਾਰਨ ਸਾਨੂੰ ਇੱਕ ਟਰਾਂਸਲੇਟਰ ਰੱਖਣਾ ਪਿਆ ਸੀ ਜੋ ਕਿ ਸਾਡੀ ਲੈਂਗੁਏਜ ਉਹਨਾਂ ਨੂੰ ਸਮਝਾ ਸਕੇ ਔਰ ਉਹਨਾਂ ਦੀ ਲੈਂਗੁਏਜ ਸਾਨੂੰ ਸਮਝਾ ਸਕੇ ਜਿਸ ਕਾਰਨ ਸਾਨੂੰ ਪਰੇਸ਼ਾਨੀ ਨਹੀਂ ਹੋਈ ਅਸੀਂ ਚੰਗੀ ਤਰ੍ਹਾਂ ਉੱਥੇ ਘੁੰਮੇ ਫਿਰੇ ਅਤੇ ਹਰ ਚੀਜ਼ ਦਾ ਆਨੰਦ ਲਿਆ